ਹਾਂ ਕਿਸਾਨਾਂ ਦੀ ਖੁਦਕੁਸ਼ੀ ਦੇ ਸੰਬੰਧ ਵਿੱਚ ਇੱਦਾਂ ਹੈ ਵੀ ਆਪਣੇ ਜਦੋਂ ਕਿਸਾਨ ਆਪਣੀ ਬੜੀ ਮਿਹਨਤ ਕਰਦੇ ਹੈ ਤਕਰੀਬਨ ਕਈ ਵਾਰੀ ਕੁਦਰਤੀ ਆਫਤਾਂ ਆ ਜਾਂਦੀਆਂ ਉਹਨਾਂ ਨੂੰ ਮੌਕੇ ਦੇ ਅਨੁਸਾਰ ਮਤਲਬ ਸੰਭਾਲਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਫਿਰ ਸਰਕਾਰਾਂ ਜਿਹੜੀਆਂ ਕਾਫੀ ਜੱਦੋ ਜਹਿਦ ਕਰਦੀਆਂ ਹੈਲਪ ਕਰਦੀਆਂ ਉਹਨਾਂ ਨੂੰ ਮੁਆਵਜ਼ਾ ਵੀ ਦਿੰਦੀਆਂ ਇਸ ਸੰਬੰਧ ਦੇ ਵਿੱਚ ਹੈਲਪਲਾਈਨਾਂ ਵੀ ਸਰਕਾਰਾਂ ਨੇ ਦਿੱਤੀਆਂ ਕਾਫੀ ਮਤਲਬ ਹੈਲਪਲਾਈਨ ਦੇ ਉੱਤੇ ਰਾਹਤਾਂ ਮਿਲਦੀਆਂ ਅਤੇ ਸਾਡੇ ਸਾਰੇ ਖੇਤਰਾਂ ਵਿੱਚ ਤਕਰੀਬਨ ਸਰਕਾਰ ਨੇ ਦੇਸ਼ ਦੀ ਮਤਲਬ ਸਲਾਹ ਕੇਂਦਰ ਵੀ ਨੇ ਅਤੇ ਇਹ ਪਰਿਵਾਰਾਂ ਲਈ ਹੈ ਜੇ ਕਿਸਾਨਾਂ ਦੇ ਪਰਿਵਾਰਾਂ ਲਈ ਕਿ ਸਾਰਿਆਂ ਲਈ ਔਖਾ ਕਿਉਂਕਿ ਜਦੋਂ ਫਸਲ ਜਾਂ ਹੋਰ ਚੀਜ਼ ਤਿਆਰ ਕਰਨੀ ਅਤੇ ਉਹ ਮੌਕੇ 'ਤੇ ਕੁਦਰਤੀ ਆਫਤ ਕੋਈ ਆ ਜਾਵੇ ਜਾਂ ਮੁਸ਼ਕਲ ਆ ਜਾਵੇ ਕਿ ਉਹਨੂੰ ਨਜਿੱਠਣਾ ਪੈਂਦਾ ਜਿਵੇਂ ਹੁਣ ਵੀ ਕਿਸਾਨ ਜ਼ਿਮੀਦਾਰ ਆਪਣੇ ਮਤਲਬ ਹੱਕ ਲੈਣ ਲਈ ਜੱਦੋ ਜਹਿਦ ਕਰ ਰਹੇ ਹੈ ਟਾਈਮ ਟੂ ਟਾਈਮ ਸੱਜੇ ਖੱਬੇ ਮਤਲਬ ਇਹ ਸਰਕਾਰਾਂ ਦੇ ਨਾਲ ਵੀ ਮੀਟਿੰਗਾਂ ਕਰਦੇ ਰਹਿੰਦੇ ਆ ਸੋ ਇਹ ਆ ਵੀ ਕਿਸਾਨ ਜਦੋਂ ਐਕਸਟਰਾ ਆਪਣੇ ਕੰਮ ਕਾਜ ਕਰਦੇ ਹੈ ਖੇਤਾਂ ਵਿੱਚ ਜਾਂ ਹੋਰ ਅਤੇ ਉਹਨਾਂ ਨੂੰ ਕਈ ਵਾਰੀ ਮੁਸ਼ਕਲ ਆਉਂਦੀ ਹੈ ਇਸ ਕਰਕੇ ਇਹ ਕਿਸਾਨ ਕੋਸ਼ਿਸ਼ ਤਾਂ ਸਰਕਾਰਾਂ ਬੜੀਆਂ ਕਰ ਰਹੀਆਂ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਦੀਆਂ ਭਾਈ ਇਸ ਪਾਸੇ ਨਾ ਚੱਲੋ ਆਪਣੀ ਮਿਹਨਤ ਕਰੋ ਠੀਕ ਹੈ ਜ਼ਿਮੀਦਾਰਾ ਕਰੋ ਇਹਦੇ ਵਿੱਚੋਂ ਤੁਹਾਨੂੰ ਬਹੁਤ ਬੈਨੀਫਿਟ ਹੈ ਓਕੇ